ਭਾਰਤ ਵਿੱਚ ਛੋਟੇ ਛੋਟੇ ਕਾਰੋਬਾਰ ਇਹ ਕਿੰਨੇ ਪਰਿਵਾਰਾਂ ਦਾ ਰੋਜ਼ਗਾਰ ਦਾ ਸਾਧਨ ਹਨ ਗਲੀ ਦੇ ਹਰ ਨੁੱਕਰ 'ਚ ਸਾਨੂੰ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਲੱਭ ਹੀ ਜਾਂਦੀ ਹੈ ਫਿਰ ਔਰਤਾਂ ਨੇ ਘਰਾਂ 'ਚ ਬਿਊਟੀ ਪਾਰਲਰ ਖੋਲ ਰੱਖੇ ਹਨ ਜਾਂ ਕਿਸੇ ਨੇ ਸਿਲਾਈ ਬੁਣਾਈ ਦਾ ਜਾਂ ਬੁਟੀਕ ਖੋਲ ਰੱਖਿਆ ਹੈ ਜੇ ਵੱਡੇ ਸ਼ਹਿਰਾਂ 'ਚ ਦੇਖੀਏ ਤਾਂ ਔਰਤਾਂ ਟਿਫਨ ਸਰਵਿਸ ਬਹੁਤ ਬਾਖੂਬੀ ਚਲਾ ਰਹੀਆਂ ਹਨ ਅਤੇ ਪਹਾੜੀ ਔਰਤਾਂ ਮੋਮਬੱਤੀ ਦੀਵੇ ਅਚਾਰ ਬਣਾਉਣ ਦਾ ਕੰਮ ਕਰਦੀਆਂ ਹਨ ਪਿਛਲੇ ਪੰਜ ਸਾਲਾਂ 'ਚ ਸਰਕਾਰ ਨੇ ਇਹਨਾਂ ਛੋਟੇ ਛੋਟੇ ਕਾਰੋਬਾਰਾਂ ਲਈ ਕਾਫ਼ੀ ਸਕੀਮਾਂ ਵੀ ਕੱਢੀਆਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਰੁਜ਼ਗਾਰ ਵਧਾਉਣ ਵਿੱਚ ਬਹੁਤ ਸਹਾਇਕ ਹਨ